ਅਸੀਂ ਦੋ ਭਰਾ ਅਤੇ ਦੋ ਭੈਣਾਂ ਹਨ ਜਿਨ੍ਹਾਂ ਵਿੱਚ ਭਰਾ ਵੱਡਾ ਜਿਹੜਾ ਉਹ ਪ੍ਰਾਈਵੇਟ ਜੌਬ ਕਰਦਾ ਸੀ ਅਤੇ ਮੈਂ ਆਰਮੀ ਤੋਂ ਜੌਬ ਕੀਤੀ ਹੈ ਜਿਸ ਵਿੱਚ ਸਿਸਟਰ ਸਾਡੀ ਹਾਊਸਈਫ਼ ਹੈ ਅਤੇ ਦੂਜੀ ਸਿਸਟਰ ਜਿਹੜੀ ਹੈ ਉਹ ਪ੍ਰਾਈਵੇਟ ਜੌਬ ਕਰਦੀ ਹੈ ਉਹਨਾਂ ਤੋਂ ਮੇਰਾ ਕਾਫੀ ਅਲੱਗ ਇੱਕ ਰੁਤਬਾ ਰਿਹਾ ਹੈ ਕਿ ਮੈਂ ਫ਼ੌਜ ਵਿੱਚ ਰਿਹਾ ਹਾਂ ਫ਼ੌਜ ਦਾ ਕਾਫੀ ਤਜਰਬਾ ਹੈ ਸਾਡੇ ਕੋਲ ਅਤੇ ਜਿਨ੍ਹਾਂ ਵਿੱਚ ਕਾਰਨ ਬਾਅਦ ਵਿੱਚ ਬਹੁਤ ਹੀ ਵਧੀਆ ਜੀਵਨ ਬਤੀਤ ਹੁੰਦਾ ਹੈ ਅਤੇ ਉਹ ਮੇਰੇ ਤੋਂ ਸਿਵਲ ਦੇ ਹਨ ਅਤੇ ਇਹੀ ਸਾਡਾ ਹੈ ਫਰਕ ਹੈ ਫ਼ੌਜ ਅਤੇ ਸਿਵਲ ਦਾ